ਬਚਪਨ ਵਿੱਚ ਅਸੀਂ ਸਾਰੇ ਬਹੁਤ ਸਾਰੀਆਂ ਗੇਮਾਂ ਖੇਡੀਆਂ ਹੈ ਕਿਉਂਕਿ ਸਾਡੇ ਕੋਲ ਟਾਇਮ 'ਚ ਨਾ ਤਾਂ ਕੋਈ ਮੋਬਾਇਲ ਹੁੰਦੇ ਸੀ ਨਾ ਕੋਈ ਸੋਸ਼ਲ ਮੀਡੀਆ ਨਾ ਕੋਈ ਇੰਨਟਰਟੇਨਮੈਂਟ ਦੇ ਹੋਰ ਸਾਧਨ ਤਾਂ ਸਾਡਾ ਜ਼ਿਆਦਾਤਰ ਟਾਇਮ ਜਿਹੜਾ ਪਲੇ ਗਰਾਊਂਡ 'ਚ ਹੀ ਹੋਇਆ ਕਰਦਾ ਸੀ ਕ੍ਰਿਕਟ ਹੋਕੀ ਵੋਲੀਬੋਲ ਬਾਸਕਿਟਬੋਲ ਗੁੱਲੀ ਡੰਡਾ ਗੇਂਦ ਫੈਂਕ ਪਿੱਠੂ ਇਹੋ ਜਿਹੀਆਂ ਬਹੁਤ ਸਾਰੀਆਂ ਗੇਮਾਂ ਸੀਗੀਆਂ ਜਿਹੜੀਆਂ ਅਸੀਂ ਅਕਸਰ ਰੋਜਾਨਾ ਸ਼ਾਮ ਨੂੰ ਖੇਡਿਆ ਕਰਦੇ ਸੀ ਕ੍ਰਿਕੇਟ ਤਾਂ ਜਿਹੜੀ ਮੋਸਟਲੀ ਸਾਰੇ ਬਚਪਨ 'ਚ ਹੀ ਖੇਡਦੇ ਹੈ ਕ੍ਰਿਕੇਟ ਦੇ ਵਿੱਚ ਉਹ ਹੀ ਗਿਆਰਾਂ ਪਲੇਅਰ ਇੱਕ ਪਾਸੇ ਗਿਆਰਾਂ ਪਲੇਅਰ ਦੂਜੇ ਪਾਸੇ ਹੋਇਆ ਕਰਦੇ ਸੀ ਅਤੇ ਇੱਕ ਬੈਟ ਇੱਕ ਬੈਟ ਹੁੰਦਾ ਸੀਗਾ ਜਿਹਦੇ ਨਾਲ ਅਸੀਂ ਖੇਡਦੇ ਸੀਗੇ ਅਤੇ ਇੱਕ ਬੋਲ ਕਰਾਉਣ ਵਾਲਾ ਬੰਦਾ ਹੁੰਦਾ ਸੀਗਾ ਬਾਕੀ ਨੌਰਮਲ ਫੀਲਡਿੰਗ ਕਰਿਆ ਕਰਦੇ ਸੀਗੇ ਅਤੇ ਬੋਂਡਰੀ ਰੱਖੀ ਹੋਈ ਸੀਗੀ ਇੱਕ ਗਲੀ ਦੇ ਵਿੱਚ ਜਿਹੜੇ ਸੀਗੇ ਅਗਰ ਕੋਈ ਗੋਅ ਗਲੀ ਤੋਂ ਬਾਹਰ ਚਲੀ ਜਾਵੇ ਬੋਲ ਤਾਂ ਆਊਟ ਹੈ ਅਤੇ ਅਗਰ ਵਿਕਟ 'ਤੇ ਲੱਗ ਜਾਵੇ ਫਿਰ ਆਊਟ ਹੈ ਅਤੇ ਅਗਰ ਦੀਵਾਰ 'ਤੇ ਲੱਗ ਜਾਵੇ ਤਾਂ ਉਹ ਚੌਕਾ ਹੈ ਅ ਅਗਰ ਦੀਵਾਰ 'ਤੇ ਉੱਪਰਲੀ ਸਾਇਡ 'ਤੇ ਲੱਗ ਜਾਵੇ ਤਾਂ ਛੱਕਾ ਰੱਖਿਆ ਹੁੰਦਾ ਸੀਗਾ ਇਸ ਤਰ੍ਹਾਂ ਸਾਡੇ ਉਹ ਆਪ ਹੀ ਆਪਣੇ ਨਿਯਮ ਬਣਾਏ ਹੋਏ ਸੀਗੇ ਗੇਮ ਦੇ ਹਿਸਾਬ ਨਾਲ ਹੋਕੀ ਦਾ ਤਾਂ ਫਿਰ ਜਿਵੇਂ ਹੁੰਦੀ ਹੈ ਗੇਮ ਇੱਕ ਅ ਹ ਹਰੇਕ ਕੋਲ ਆਪਣੀ ਆਪਣੀ ਸਟਿੱਕ ਹੁੰਦੀ ਸੀਗੀ ਅਤੇ ਬੋਲ ਹੋਇਆ ਕਰਦੀ ਸੀ ਅਤੇ ਅਸੀਂ ਇੱਧਰਲੇ ਪਾਸੇ ਛੇ ਜਣੇ ਹੁੰਦੇ ਸੀਗੇ ਦੂਜੇ ਪਾਸੇ ਵੀ ਛੇ ਜਣੇ ਅਤੇ ਛੇ ਜਣਿਆਂ ਨੇ ਦੂਜੇ ਦੇ ਪਾਲੇ ਦੇ ਵਿੱਚ ਗੇਂਦ ਪਾ ਕੇ ਆਊਟ ਕਰਨਾ ਹੁੰਦਾ ਸੀਗਾ ਅਤੇ ਵੋਲੀਬੋਲ ਦੇ ਵਿੱਚ ਪੰਜ ਬੰਦੇ ਨੈੱਟ ਦੇ ਇੱਧਰਲੇ ਪਾਸੇ ਪੰਜ ਬੰਦੇ ਉੱਧਰਲੇ ਪਾਸੇ ਅਤੇ ਵੋਲੀਬੋਲ ਖੇਡਿਆ ਕਰਦੇ ਸੀਗੇ ਜਿਹਦੇ ਵਿੱਚ ਨੋਰਮਲੀ ਹੁੰਦਾ ਸੀ ਵੀ ਠੱਪਾ ਨਹੀਂ ਲੱਗਣਾ ਚਾਹੀਦਾ ਬੋਲ ਦਾ ਅਤੇ ਦੋ ਵਾਰੀ 'ਚ ਪਾਸ ਹੋ ਕੇ ਦੂਜੇ ਵਾਲੇ ਪਾਸੇ ਦੂਜੇ ਦੇ ਪਾਲੇ 'ਚ ਚਲੀ ਜਾਵੇ ਅਤੇ ਅਗਰ ਇਸ ਤਰ੍ਹਾਂ ਦੀ ਨਹੀਂ ਕੋਈ ਕੰਡੀਸ਼ਨ ਬਣਦੀ ਸੀ ਫਿਰ ਉਹ ਆਉਟ ਹੋ ਜਾਇਆ ਕਰਦਾ ਸੀਗਾ ਫਿਰ ਉਹ ਹੀ ਪੁਆਇੰਟ ਇਕੱਠੇ ਹੁੰਦੇ ਜਾਂਦੇ ਸੀਗੇ ਜਿਹੜਾ ਆਉਟ ਕਰੀ ਜਾਂਦਾ ਸੀਗਾ ਪੁਆਇੰਟ ਇਕੱਠੇ ਕਰੀ ਜਾਂਦਾ ਫਿਰ ਬਾਸਕੇਟਬੋਲ ਦੇ ਵਿੱਚ ਇਹ ਹੀ ਰਹਿੰਦਾ ਸੀਗਾ ਵੀ ਛੇ ਬੰਦੇ ਇੱਧਰਲੇ ਪਾਸੇ ਛੇ ਉੱਧਰਲੇ ਪਾਸੇ ਅਤੇ ਜਿਹੜੀ ਬਾਸਕਿਟ ਹੁੰਦੀ ਸੀਗੀ ਪਲੇਅਰ ਦੀ ਉਹਦੇ ਦੇ ਵਿੱਚ ਜਾ ਕੇ ਗੋਲ ਕਰਨਾ ਹੁੰਦਾ ਸੀਗਾ ਅਤੇ ਉਹਦੇ 'ਚ ਬਸ ਇਸ ਤਰ੍ਹਾਂ ਬੋਲ ਦਾ ਹੁੰਦਾ ਸੀਗਾ ਵੀ ਬੋਲ ਦੇ ਪੈਰ ਕੋਈ ਨਾ ਲੱਗੇ ਹੱਥ ਨਾਲ ਹੀ ਠੱਪੇ ਮਾਰਦੇ ਹੋਏ ਲੈ ਕੇ ਜਾਣਾ ਹੁੰਦਾ ਸੀ ਅਤੇ ਗੁੱਲੀ ਡੰਡਾ ਦੇ ਵਿੱਚ ਹੁੰਦਾ ਸੀਗਾ ਵੀ ਗੁੱਲੀ ਜਿਹੜੀ ਹੈ ਮੈਕਸੀਮਮ ਦੂਰ ਤੇ ਦੂਰ ਤੋਂ ਦੂਰ ਤੇ ਦੂਰ ਜਾਵੇ ਅਤੇ ਉਸ ਦੇ ਨਾਲ ਹੀ ਉੱਥੋਂ ਬੰਦਾ ਜਿਹੜਾ ਹੈ ਜਿੱਥੇ ਪਾਸੇ ਗੁੱਲੀ ਸਿੱਟੀ ਜਾਂਦੀ ਸੀਗੀ ਉਹ ਨੀਚੇ ਡੰਡਾ ਰੱਖ ਦਿੰਦਾ ਸੀ ਖੇਡਣ ਤੋਂ ਬਾਅਦ ਅਤੇ ਗੁੱਲੀ ਨੂੰ ਗੁੱਲੀ ਦੇ ਨਾਲ ਟੱਚ ਕਰਨਾ ਹੁੰਦਾ ਸੀ ਡੰਡਾ ਅਗਰ ਡੰਡੇ 'ਤੇ ਟੱਚ ਹੋ ਗਿਆ ਤਾਂ ਆਉਟ ਹੈ ਨਹੀਂ ਹੋਇਆ ਤਾਂ ਫਿਰ ਦੁਬਾਰਾ ਫਿਰ ਉਹ ਲ ਕਰਦਾ ਸੀਗਾ ਜਿੰਨਾ ਡਿਸਟੈਂਸ ਵਧੀ ਜਾਂਦਾ ਸੀਗਾ ਉਹਦਾ ਵਿਨਰ ਹੋ ਜਾਂਦਾ ਸੀਗਾ ਅਤੇ ਇੱਕ ਪਿੱਠੂ ਗੇਮ ਹੋਇਆ ਕਰਦੀ ਸੀ ਜਿਸ ਦੇ ਵਿੱਚ ਨਾ ਸੱਤ ਅੱਠ ਜਿਹੜੇ ਹੈ ਉਹ ਕੰਕਰ ਪੱਥਰ ਜਿਹੇ ਰੱਖ ਦਿੰਦੇ ਸੀ ਪੱਥਰ ਦੇ ਉੱਪਰ ਪੱਥਰ ਅਤੇ ਬੋਲ ਦੇ ਨਾਲ ਗਿਰਾਉਣਾ ਹੁੰਦਾ ਸੀਗਾ ਅਗਰ ਤਾਂ ਗਿਰ ਗਿਆ ਫਿਰ ਤਾਂ ਆਉਟ ਹੈ ਨਹੀਂ ਗਿਰਦਾ ਸੀ ਤਾਂ ਫਿਰ ਬੋਲ ਜਿਹੜੀ ਹੈ ਉਹ ਪਿੱਠ 'ਤੇ ਮਾਰਿਆ ਕਰਦੀ ਸੀ ਉਹਨੂੰ ਪਿੱਠੂ ਕਿਹਾ ਕਰਦੇ ਸੀਗੇ ਵੀ ਇਸ ਤਰ੍ਹਾਂ ਇਹ ਗੇਮਾਂ ਜਿਹੜੀਆਂ ਸਾਡੀਆਂ ਇਹ ਬੜੀਆਂ ਪਾਪੂਲਰ ਗੇਮਾਂ ਹੋਇਆ ਕਰਦੀਆਂ ਸੀਗੀਆਂ